ਦੋ ਮਾਰਚ ਉੱਨੀ ਅਠੱਨਵੇਂ ਪੰਦਰਾਂ ਅਪ੍ਰੈਲ ਉੱਨੀ ਨੜਿੱਨਵੇਂ ਵੀਹ ਜਨਵਰੀ ਵੀਹ ਚੌਦਾਂ ਪੱਚੀ ਮਈ ਵੀਹ ਪੰਦਰਾਂ ਤੀਹ ਦਸੰਬਰ ਵੀਹ ਵੀਹ